ਹੈਲੋ ਹਾਂਜੀ ਵੀਰ ਜੀ ਸਰ ਤੁਸੀਂ ਜਿੰਮ ਟਰੇਨਰ ਬੋਲਦੇ ਹਾਂਜੀ ਹਾਂਜੀ ਸਰ ਮੈਂ ਨਾ ਤੁਹਾਡੀ ਐਡਵੋਟੀਜ਼ਮੈਂਟ ਦੇਖੀ ਸੀਗੀ ਮੈਨੂੰ ਫਰੈਂਡ ਨੇ ਨਾਲ ਰਿਕਮੈਂਡ ਵੀ ਕੀਤਾ ਸੀਗਾ ਸਰ ਮੈਂ ਨਾ ਜਿੰਮ ਜੁਆਇਨ ਕਰਨਾ ਚਾਹੁੰਦਾ ਤੁਹਾਡੇ ਕੋਲ ਅਤੇ ਕੀ ਟਾਈਮਿੰਗ ਵਗੈਰਾ ਕੀ ਹੈਗੀ ਤੁਹਾਡੀ ਸਰ ਮੇਰੀ ਏਜ ਕੋਈ ਇੱਕੀ ਕੁ ਸਾਲ ਹੈਗੀ ਏ ਸਰ ਵੇਟ ਹੀ ਸਰ ਘਟਾਉਣਾ ਨਾ ਵੇਟ ਮੇਰਾ ਪਚਾਸੀ ਕਿੱਲੋ ਹੈ ਵੈਸੇ ਮੈਂ ਚਾਹੁੰਦਾ ਮੇਰਾ ਵੇਟ ਘੱਟ ਜੇ ਹਾਂਜੀ ਹਾਂਜੀ ਸਰ ਮਸ਼ੀਨਾਂ ਵਗੈਰਾ ਪ੍ਰੋਪਰ ਹੈਗੀਆਂ ਨਾ ਤੁਹਾਡੇ ਕੋਲ ਠੀਕ ਹੈ ਸਰ ਠੀਕ ਠੀਕ ਹੈ ਸਰ ਠੀਕ ਹੈ ਸਰ ਆਪਣਾ ਹਾਂਜੀ ਹਾਂਜੀ ਸਰ ਡੈਮੋ ਕਲਾਸਿਸ ਅਵੇਲੇਬਲ ਨੇ ਡੈਮੋ ਕਲਾਸਿਜ ਮਿਲ ਸਕਦੀਆਂ ਹਾਂ ਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਸਰ ਓਕੇ ਸਰ ਮੈਂ ਨਾ ਤੁਹਾਨੂੰ ਫਿਰ ਮੈਂ ਤੁਹਾਨੂੰ ਕੋਂਟੈਕਟ ਕਰਾਂਗਾ ਜਲਦੀ ਠੀਕ ਹੈ ਨਾ ਸਰ ਠੀਕ ਹੈ ਸਰ ਥੈਂਕ ਯੂ ਸੋ ਮੱਚ ਸਰ